ਮੈਂ ਹਰਜੀਤ ਕੌਰ ਗਰਦਾਸਪੁਰ ਤੋਂ ਬੋਲਦੀ ਹਾਂ ਕਿ ਪਹਿਲਾਂ ਜਿਹੜੇ ਪ੍ਰੈਸ਼ਰ ਕੂਕਰ ਦੀ ਲੋਕ ਵਰਤੋਂ ਕਰਦੇ ਸੀ ਹੈ ਅਤੇ ਬੜਾ ਵਧੀਆ ਕੰਮ ਸੀ ਸਭ ਤੋਂ ਵੀ ਚਲੋ ਰੋਟੀ ਪਾਣੀ ਜਲਦੀ ਬਣ ਜਾਂਦਾ ਸਭ ਕੁਝ ਮਤਲਬ ਕਿ ਜਲਦੀ ਹੋ ਜਾਂਦਾ ਵਾ ਪਰ ਜਿਹੜਾ ਪਹਿਲਾਂ ਸੀ ਸਾਡੇ ਮਾਂ ਬਾਪ ਦੀ ਵਾਰੀ ਉਦੋਂ ਮਤਲਬ ਕਿ ਦੇਗਿਆਂ ਦੇ ਵਿੱਚ ਸਾਰਾ ਕੰਮ ਵਗੈਰਾ ਕਰਨਾ ਦਾਲ ਦੇਗੇ ਦੇ ਵਿੱਚ ਭੜੋਲੀ ਦੇ ਵਿੱਚ ਜਿੱਦਾਂ ਸਵੇਰ ਤੋਂ ਧਰ ਛੱਡਣੀ ਉਹਨੇ ਹੌਲੀ ਹੌਲੀ ਬਣਦੀ ਰਹਿਣਾ ਬੜਾ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਭੋਜਨ ਜਿਹੜਾ ਸੀ ਉਹ ਤਿਆਰ ਹੋ ਜਾਂਦਾ ਸੀ ਪਰ ਅੱਜ ਕੱਲ੍ਹ ਹੁਣ ਪ੍ਰੈਸ਼ਰ ਕੁਕਰ ਦੀ ਵਿੱਚ ਵਰਤੋਂ ਕਰਨ ਦੇ ਬਾਵਜੂਦ ਕਈ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਕਿਉਂਕਿ ਹਰ ਚੀਜ਼ ਜਿਹੜੀ ਹੈਗੀ ਆ ਹੁਣ ਇਹ ਪ੍ਰੈਸ਼ਰ ਦੇ ਨਾਲ ਹੀ ਬਣਦੀ ਆ ਅਤੇ ਪਹਿਲਾਂ ਇਹ ਚੀਜ਼ ਨਹੀਂ ਸੀ ਹੈਗੀ ਪਹਿਲਾਂ ਤਾਂ ਚਲੋ ਮਤਲਬ ਕਿ ਬੜੇ ਰੋਟੀ ਬਣਾਉਣੀ ਭ ਭੜੋਲੀਆਂ ਦੇ ਵਿੱਚ ਅੱਗ ਵੀ ਬਾਲਣੀ ਅੱਗ ਦੇ ਉੱਤੇ ਹੀ ਲੋਕਾਂ ਨੇ ਦਾਲ ਸਬਜ਼ੀ ਮਤਲਬ ਕਿ ਧਰ ਛੱਡਣੀ ਅਤੇ ਹੁਣ ਅੱਜ ਕੱਲ੍ਹ ਜਿਹੜਾ ਵਾ ਅੱਜ ਕੱਲ੍ਹ ਹਰ ਬੰਦਾ ਪ੍ਰੈਸ਼ਰ ਕੂਕਰ ਦੀ ਹੀ ਵਰਤੋਂ ਮਤਲਬ ਕਿ ਕਰਦਾ ਪਿਆ ਵਾ ਅਤੇ ਪਹਿਲਾਂ ਸਾਡੇ 'ਚ ਜਿੱਦਾਂ ਮਾਂ ਬਾਪ ਜਿੱਦਾਂ ਮੇਰੀ ਸੀ ਸੱਸ ਸੀ ਮੇਰੀ ਦਾਦੀ ਜੀ ਮੇਰੇ ਮੰਮੀ ਇਹ ਸਾਰਾ ਹੀ ਕੰਮ ਕਿ ਪਹਿਲਾਂ ਦੇਗਿਆਂ ਦੇ ਵਿੱਚ ਹੀ ਦਾਲ ਨੂੰ ਧਰ ਛੱਡਨਾ ਹੌਲੀ ਹੌਲੀ ਜਿੱਦਾਂ ਦੁੱਧ ਵੀ ਉਬਾਲਣਾ ਕਾੜ੍ਹਨੀਆਂ ਦੇ ਵਿੱਚ ਥੋੜ੍ਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਰਦੇ ਰਹਿਣਾ ਫਿਰ ਹੌਲੀ ਹੌਲੀ ਹੌਲੀ ਹੌਲੀ ਉਹ ਸਾਰਾ ਰਾਤ ਤੱਕ ਆਏਂ ਵਧੀਆ ਫਸ ਕਲਾਸ ਚੀਜ਼ ਬਣ ਕੇ ਇੰਨੀ ਵਧੀਆ ਤਿਆਰ ਹੋ ਜਾਂਦੀ ਕਿ ਹਰ ਬੰਦਾ ਮਤਲਬ ਕਿ ਉਹਦੀ ਸਲਾਹ ਹੀ ਕਰਦਾ ਪੀ ਮਿਲ ਕੇ ਵਧਿਆ ਸਬਜ਼ੀ ਬਣਦੀ ਹੈ ਅਤੇ ਅੱਜ ਕੱਲ੍ਹ ਲੋਕ ਖਾਂਦੇ ਤਾਂ ਹੈ ਵਾ ਸਾਰਾ ਕੁਛ ਪ੍ਰੈਸ਼ਰ ਕੁਕਰ ਵਿੱਚ ਸਾਰਾ ਕੁਝ ਕਰਦੇ ਤਾਂ ਹੈ ਵਾ ਪਰ ਫਿਰ ਵੀ ਉਹੋ ਜਿਹੀ ਚੀਜ਼ ਮਤਲਬ ਕਿ ਨਹੀਂ ਬਣਦੀ ਹੈਗੀ ਜਿਹੋ ਜਿਹੀ ਪਹਿਲੀਆਂ ਚੀਜ਼ਾਂ ਵਗੈਰਾ ਬਣਦੀਆਂ ਤਿਆਰ ਹੋ ਜਾਂਦੀਆਂ ਹੀ ਜਿਹੜੀਆਂ ਸਬਜ਼ੀਆਂ ਸੀ ਉਹ ਵੀ ਲੋਕਾਂ ਨੇ ਅੱਗ 'ਤੇ ਬਣਾਉਣੀਆਂ ਕੜਾਹੀ ਦੇ ਵਿੱਚ ਬਣਾਉਣੀਆ ਵਧੀਆ ਤਰ੍ਹਾਂ ਮਤਲਬ ਕਿ ਬਣਾਉਣੀਆਂ ਹੌਲੀ ਹੌਲੀ ਮੱਠੀ ਮੱਠੀ ਅੱਗ ਦੇ ਉੱਤੇ ਉਹ ਚੀਜ਼ ਨੇ ਰਿੱਝਣਾ ਬਣਨਾ ਫਿਰ ਉਹਨੇ ਤਿਆਰ ਹੋਣਾ ਅਤੇ ਬਹੁਤ ਹੀ ਮਤਲਬ ਕਿ ਖਾਣ ਵਿੱਚ ਵੀ ਸਵਾਦ ਅਲੱਗ ਜਿਹਾ ਹੀ ਆ ਜਾਂਦਾ ਸੀ ਅਤੇ ਹੁਣ ਇਹ ਆ ਵੀ ਜਿਹੜਾ ਪ੍ਰੈਸ਼ਰ ਕੁਕਰ ਹੈਗਾ ਵਾ ਪ੍ਰੈਸ਼ਰ ਕੁਕਰ ਦੇ ਵਿੱਚ ਚੀਜ਼ ਚਲੋ ਬਣ ਜਾਂਦੀ ਆ ਪਰ ਉਹੋ ਜਿਹਾ ਮਤਲਬ ਕਿ ਨਹੀਂ ਸਵਾਦ ਹੈਗਾ ਅੱਜ ਕੱਲ੍ਹ ਕਈ ਪ੍ਰੈਸ਼ਰ ਕੁਕਰ ਤੋਂ ਬਿਮਾਰੀਆਂ ਵਗੈਰਾ ਪੈਦਾ ਵੀ ਹੋ ਜਾਂਦੀਆਂ ਨੇ